ਹੈਲੋ ਹਾਂਜੀ ਮੈਂ ਜੋਤੀ ਬੁੱਕ ਸਟੋਰ ਤੋਂ ਬੋਲ ਰਿਹਾ ਤੁਸੀਂ ਕੌਣ ਬੋਲ ਰਹੇ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਹਾਂਜੀ ਮੈਮ ਹਾਂਜੀ ਮੈਮ ਤੁਹਾਨੂੰ ਦੱਸਦੀ ਹਾਂ ਹਾਂਜੀ ਹਾਂਜੀ ਮੈਮ ਮੈਂ ਤੁਹਾਨੂੰ ਦੱਸ ਦੀ ਹਾਂ ਸਾਡੇ ਕੋਲ ਪੈਨਸਲਾਂ ਕਾਫ਼ੀ ਮਤਲਬ ਕੁਐਂਟਟੀ 'ਚ ਆ ਨਾਲੇ ਅਲੱਗ ਅਲੱਗ ਕੰਪਨੀ 'ਚ ਹੈਗੀਆਂ ਹਾਂ ਮਤਲਬ ਇਹ ਪ੍ਰਾਈਸ ਵੀ ਡਿਫਰੈਂਟ ਹੈ ਔਰ ਡਿਫਰੈਂਟ ਕੰਪਨੀਜ਼ ਔਰ ਡਿਫਰੈਂਟ ਪ੍ਰਾਈਜ ਮਤ ਅਲੱਗ ਅਲੱਗ ਕੰਪਨੀਆਂ ਦੇ ਅਲੱਗ ਅਲੱਗ ਹੀ ਪ੍ਰਾਈਜਜ ਹੋਣਗੇ ਅਤੇ ਤੁਹਾਨੂੰ ਮੈਂ ਜਿੱਦਾਂ ਟੈੱਨ ਰੁਪੀਸ ਦੀ ਵੀ ਪੈਨਸਲ ਆਉਂਦੀ ਹੈ ਪੰਜ ਰੁਪਏ ਦੀ ਵੀ ਪੈਨਸਲ ਆਉਂਦੀਆਂ ਵਾਂ ਅਤੇ ਪੈਕਿੰਗ ਵੀ ਆਉਂਦੀਆਂ ਵਾਂ ਜਿੱਦਾਂ ਪੈਕਿੰਗ ਸੱਠ ਸੱਠ ਰੁਪਏ ਦੇ ਪੈ ਜਾਂਦੇ ਆ ਅਤੇ ਤੁਸੀਂ ਜਿੱਦਾਂ ਕਹੋਗੇ ਅਸੀਂ ਉੱਦਾਂ ਹੀ ਮੈਂ ਤੁਹਾਨੂੰ ਅਸੀਂ ਦਵਾਂਗੇ ਜਿੱਦਾਂ ਤੁਹਾਨੂੰ ਚਾਹੀਦੇ ਇੱਦਾਂ ਹੀ ਈਰੇਜ਼ਰ ਹੈ ਈਰੇਜ਼ਰ ਦੀਆਂ ਵੀ ਕਾਫ਼ੀ ਮਤਲਬ ਕੰਪਨੀਆਂ ਵਾ ਡੋਮਸ ਕੰਪਨੀ ਆ ਗਈ ਜਿੱਦਾਂ ਅ ਨਟਰਾਜ ਆ ਗਈ ਆ ਠੀਕ ਆ ਕਾਫ਼ੀ ਮਤਲਬ ਆਉਂਦੀਆਂ ਵਾ ਤੁਸੀਂ ਜਿਹੜੀ ਸਾਨੂੰ ਕਹੋਗੇ ਅਸੀਂ ਤੁਹਾਨੂੰ ਉਹ ਹੀ ਦਵਾਂਗੇ ਮਤਲਬ ਘੱਟ ਰੇਟ ਵਾਲੀਆਂ ਵੀ ਹੈਗੀਆਂ ਅਤੇ ਜ਼ਿਆਦਾ ਰੇਟ ਵਾਲੀਆਂ ਵੀ ਹੈਗੀਆਂ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਦਾ ਰੇਟ ਚਾਹੀਦਾ ਹਾਂਜੀ ਜੇ ਤੁਹਾਨੂੰ ਮਤਲਬ ਇੱਕ ਪੈਨਸਲ ਫਿਰ ਤੁਹਾਨੂੰ ਦੋ ਰੁਪਏ ਦੀ ਪਏਗੀ ਠੀਕ ਆ ਅਤੇ ਤੁਸੀਂ ਪੈਨਸਲ ਲੈਣੀ ਹੈ ਕਿਉਂਕਿ ਪੰਜ ਰੁਪਏ ਵਾਲੀ ਪੈਨਸਲ ਆਪਾਂ ਦੋ ਰੁਪਏ ਵਿੱਚ ਦਿੰਦੇ ਹਾਂ ਅਤੇ ਇੱਥੇ ਤੁਹਾਨੂੰ ਡਿਸਕਾਊਂਟ ਪਏਗਾ ਤਿੰਨ ਤਿੰਨ ਪਰਸੈਂਟ ਦਾ

ਤੁਸੀਂ ਪੈਨਸਲਾਂ ਹੀ ਲੈਣੀਆਂ ਵਾ ਕਿਉਂਕਿ ਤੁਹਾਨੂੰ ਹੋਰ ਕੋਈ ਚੀਜ਼ਾਂ ਨਹੀਂ ਚਾਹੀਦੀਆਂ ਨਾ ਅਤੇ ਤੁਸੀਂ ਠੀਕ ਆ ਹਾਂਜੀ ਠੀਕ ਹੈ ਇੱਕ ਮਿੰਟ ਮੈਡਮ ਮੈਂ ਲਿਖ ਦੇਵਾਂ ਹਾਂਜੀ ਠੀਕ ਹੈ ਮੈਂ ਲਿਖਦੀ ਹੈਂ ਤੁਸੀਂ ਵੇਟ ਠੀਕ ਆ ਠੀਕ ਹੈ ਮੈਮ ਹੋਰ ਚਾਰ ਸੌ ਪੈਨਸਲ ਮਤਲਬ ਚਾਰ ਸੌ ਕਿੰਨੇ ਪੈਕਟ ਚਾਹੀਦੇ ਤੁਹਾਨੂੰ ਇਹ ਕਿਉਂਕਿ ਇੱਕ ਡੱਬੇ 'ਚ ਵਿੱਚ ਪੈਨਸਲਾਂ ਦਸ ਹੁੰਦੀਆਂ ਵਾ ਅਤੇ ਫਿਰ ਉਸ ਹਿਸਾਬ ਨਾਲ ਆਪਾਂ ਤੁਹਾਨੂੰ ਇਹਦੇ ਬਿਲ ਕਰਾਵਾਂਗੇ ਪੈਨਸਲਾਂ ਦੇ ਵਿੱਚ ਵੀ ਡੱਬੀਆਂ ਦੇ ਵਿੱਚ ਵੀ ਰੇਜਰਾਂ ਹੁੰਦੀਆਂ ਸ਼ੋਪਨਰ ਹੁੰਦੇ ਆ ਅਤੇ ਉਹ ਵਿੱਚ ਇੰਕਲਿਊਡ ਵੀ ਉਹ ਵੀ ਮਤਲਬ ਕਿ ਤੁਹਾਨੂੰ ਅਲੱਗ ਪੈਕਿੰਗ ਵੀ ਦੇਵਾਂਗੇ ਅਸੀਂ ਕਿਉਂਕਿ ਪੈਕਿੰਗ ਵੀ ਆਉਂਦੀਆਂ ਵਾ ਰੇਜਰ ਦੀਆਂ ਠੀਕ ਹੈ ਟਵੈਂਟੀ ਟਵੈਂਟੀ ਵੀਹ ਵੀਹ ਦੀਆਂ ਪੈਕਿੰਗ ਹੁੰਦੀਆਂ ਵਾਂ ਹਾਂਜੀ ਹਾਂਜੀ ਅੱਜ ਕੱਲ੍ਹ ਹਾਂ ਹਾਂਜੀ ਸਾਡੇ ਕੋਲ ਕਾਫ਼ੀ ਰੇਜਰ ਆਈਆਂ ਵੀ ਹਾਂ ਜਿਹਦੇ ਵਿੱਚ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਸਾਡੇ 'ਚ ਕਾਫ਼ੀ ਰੇਜਰ ਮਤਲਬ ਆਈਆਂ ਜਿਹਦੇ ਵਿੱਚ ਕਾਫ਼ੀ ਕਾਰਟੂਨਸ ਵਗੈਰਾ ਸਟਾਰਜ਼ ਆਗੇ ਸਰਕਲ ਸ਼ੇਪਸ ਇੱਦਾਂ ਦੀਆਂ ਰੇਜਰਾਂ ਵੀ ਅਸੀਂ ਦਿੰਦੇ ਹਾਂ ਠੀਕ ਹੈ ਜੀ ਹਾਂਜੀ ਠੀਕ ਹੈ ਮੈਮ ਠੀਕ ਹੈ ਮੈਮ ਹਾਂਜੀ ਠੀਕ ਹੈ ਮੈਮ ਹੋਰ ਤੁਸੀਂ ਠੀਕ ਹੈ ਚਾਰ ਸੌ ਤੁਹਾਡੇ ਪੈਨਸਲਾਂ ਦਾ ਹੋਗਿਆ ਚਾਰ ਸੌ ਤੁਹਾਡੇ ਰੇਜਰ ਹੋ ਗਏ ਅਤੇ ਚਾਰ ਸੌ ਤੁਹਾਡੇ ਸ਼ਾਪਨਰ ਹੋ ਗਏ ਠੀਕ ਆ ਨਾਲ ਸਟਿੱਕਰ ਹਾਂਜੀ ਹਾਂਜੀ ਬਹੁਤ ਕਾਫ਼ੀਆਂ ਹੈ ਵਿਰਾਇਟੀਜ ਆ ਪੈਕਿੰਗ ਇਹਦੀ ਪੈਕਿੰਗ 'ਚ ਆਉਂਦੀਆਂ ਨਾ ਮਤਲਬ ਦਸ ਰੁਪਏ ਦੀ ਪੈਕਿੰਗ ਹੁੰਦੀ ਆ ਤੁਸੀਂ ਜਿੰਨੀਆਂ ਪੈਕਿੰਗ ਕਿਹਾ ਅਸੀਂ ਉਨੀਆਂ ਹੀ ਤੁਹਾਨੂੰ ਪਾ ਦੇਵਾਂਗੇ ਚਲੋ ਠੀਕ ਹੈ ਮੈਮ ਹੋਰ ਦੱਸੋ ਫਿਰ ਕਿ ਤੁਸੀਂ ਲੈ ਕੇ ਜਾਣਾ ਹੋਰ ਕੀ ਲੈਣਾ ਵਾਂ ਚਲੋ ਠੀਕ ਹੈ ਮੈਂ ਸਾਰਾ ਤੁਹਾਡਾ ਲਿਖ ਲੈਣਾ ਵਾ ਅਤੇ ਤੁਹਾਨੂੰ ਮਿਲ ਜਾਵੇਗਾ ਠੀਕ ਹੈ ਠੀਕ ਹੈ ਤੁਹਾਡੇ ਅਡਰੈਸ 'ਤੇ ਸਾਨੂੰ ਤੁਸੀਂ ਵੱਟਸਐਪ ਅਡਰੈਸ ਕਰ ਦਇਓ ਠੀਕ ਹੈ ਠੀਕ ਹੈ ਤੁਹਾਨੂੰ ਰੇਟ ਦੱਸ ਦੇਵਾਂਗੇ ਅਸੀਂ ਤੁਹਾਨੂੰ ਠੀਕ ਹੈ ਟੋਟਲ ਕਿੰਨਾ ਤੁਹਾਨੂੰ ਦੱਸ ਦੇਵਾਂਗੇ ਤੁਸੀਂ ਠੀਕ ਹੈ ਮੈਮ ਓਕੇ ਜੀ ਧੰਨਵਾਦ ਤੁਹਾਡਾ